ਹਾਂ ਮੈਂ ਫਿਲਮਾਂ ਜਾਂ ਟੀਵੀ ਦੇਖਣ ਲਈ ਟੀਵੀ ਸ਼ੋਅ ਦੇਖਣ ਲਈ ਨੈੱਟਫਲਿਕਸ ਜਾਂ ਪ੍ਰਾਈਮ ਵਰਗੀਆਂ ਕਈ ਸੈਂਟੀਮਿੰਗ ਸੇਵਾਵਾਂ ਦੀ ਵਰਤੋਂ ਕੀਤੀ ਹੈ ਕਿਉਂਕਿ ਇਹ ਕੇਬਲ ਤੋਂ ਸਸਤੀ ਹੁੰਦੀ ਹੈ ਦੂਸਰਾ ਇਸਦੇ ਨਾਲ ਕੀ ਹੁੰਦਾ ਹੈ ਵੀ ਜੋ ਟਾਈਮ ਹੈ ਉਹ ਵੀ ਬੱਚਦਾ ਹੈ ਜਾਂ ਬੰਦਾ ਜਦੋਂ ਵੀ ਫ੍ਰੀ ਹੁੰਦਾ ਹੈ ਉਹ ਫ੍ਰੀ ਸਮੇਂ 'ਤੇ ਬਹਿ ਕੇ ਆਪਣੀਆਂ ਜੋ ਵੀ ਮਨ ਪਸੰਦ ਸੀਰੀਅਲ ਜਾਂ ਫਿਲਮਾਂ ਜੋ ਵੀ ਵੈੱਬ ਸੀਰੀਜ਼ ਦੇਖਣੀ ਹੁੰਦੀ ਹੈ ਉਹ ਦੇਖ ਸਕਦਾ ਹੈ ਪਰ ਜੇਕਰ ਟੀਵੀ ਦੀ ਵਰਤੋਂ ਕਰੀਏ ਜਾਂ ਕੇਬਲਾਂ ਦੀ ਵਰਤੋਂ ਕਰੀਏ ਉਹ ਤਾਂ ਬੰਦਾ ਉਸੇ ਟਾਈਮ 'ਤੇ ਜਿਹੜੇ ਟਾਈਮ 'ਤੇ ਆਉਂਦੀ ਹੈ ਸਿਰਫ ਉਸੇ ਟਾਈਮ 'ਤੇ ਹੀ ਦੇਖ ਸਕਦਾ ਦੂਸਰਾ ਕਾਰਨ ਇਹ ਹੈ ਕਿ ਇਹ ਜੋ ਹੈ ਨੈੱਟਫਲਿਕਸ ਜਾਂ ਹੋਰ ਹੋਰ ਜੋ ਜਿੱਦਾਂ ਪ੍ਰਾਈਮ ਵਰਗੀਆਂ ਹੋਰ ਵੀ ਜਿਹੜੀਆਂ ਸੇਵਾਵਾਂ ਹਨ ਇਹਨਾਂ ਵਿੱਚ ਕੀ ਹੈ ਵੀ ਇੱਕ ਤਾਂ ਇਹ ਸਸਤੀਆਂ ਹੁੰਦੀਆਂ ਹਨ ਦੂਸਰਾ ਬੰਦਾ ਜਦੋਂ ਮਰਜ਼ੀ ਆਪਣੇ ਫੋਨ 'ਤੇ ਜਿਸ ਟਾਈਮ ਫ੍ਰੀ ਬੈਠਾ ਹੈ ਵੈੱਬ ਸੀਰੀਜ਼ ਜੋ ਹੈ ਦੇਖ ਸਕਦਾ ਹੈ ਅਤੇ ਸਭ ਤੋਂ ਪਹਿਲਾਂ ਹੀ ਜੋ ਟੀਵੀ 'ਤੇ ਚੀਜ਼ ਨਹੀਂ ਆਉਂਦੀ ਉਹ ਸਭ ਤੋਂ ਪਹਿਲਾਂ ਹੀ ਇਹਨਾਂ ਉੱਤੇ ਆ ਜਾਂਦੀ ਹੈ ਅਤੇ ਇੱਕ ਇਹ ਕਫ਼ਾਇਤੀ ਅਤੇ ਸਸਤੀਆਂ ਵੀ ਹੁੰਦੀਆਂ ਹਨ ਅਤੇ ਨਾਲ ਇਹਨਾਂ ਦੇ ਜਿਹੜੀ ਆਪਾਂ ਕਹਿ ਸਕੀਏ ਜੋ ਕੁਆਲਿਟੀ ਹੁੰਦੀ ਹੈ ਉਹ ਬਿਲਕੁਲ ਹੀ ਵਧੀਆ ਹੁੰਦੀ ਹੈ